ਜੀ ਹਾਂ ਮੈਂ ਬੈਂਕ ਦੇ ਦਸਤਾਵੇਜ਼ਾਂ ਨੂੰ ਆਪਣੀ ਖੇਤਰੀ ਭਾਸ਼ਾ ਵਿੱਚ ਉਪਲੱਬਧ ਕਰਵਾਉਣਾ ਪਸੰਦ ਕਰਾਂਗੀ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਪੰਜਾਬ ਵਿੱਚ ਕਈ ਲੋਕ ਪੜ੍ਹੇ ਲਿਖੇ ਹਨ ਅਤੇ ਕਈ ਲੋਕ ਪੜ੍ਹੇ ਲਿਖੇ ਨਹੀਂ ਹਨ ਪਰ ਹਾਂ ਕਈਆਂ ਲੋਕਾਂ ਨੂੰ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਉਹਨਾਂ ਨੂੰ ਪੰਜਾਬੀ ਭਾਸ਼ਾ ਤਾਂ ਪੜ੍ਹਨੀ ਆਉਂਦੀ ਹੈ ਪਰ ਇੰਗਲਿਸ਼ ਦੇ ਪੜ ਲਿਖੇ ਹੋਏ ਦਸਤਾਵੇਜ਼ਾਂ ਨੂੰ ਪੜ੍ਹਨਾ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਰੀ ਬੈਂਕ ਅਧਿਕਾਰੀ ਵੀ ਉਹਨਾਂ ਨੂੰ ਸਹੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੰਦੇ ਸੋ ਅਗਰ ਉਹ ਪੇਪਰ ਪੰਜਾਬੀ ਭਾਸ਼ਾ 'ਚ ਲਿਖੇ ਹੋਣਗੇ ਤਾਂ ਉਹ ਆਰਾਮ ਨਾਲ ਉਸ ਚੀਜ਼ ਨੂੰ ਪੜ੍ਹ ਸਕਦੇ ਹਨ ਅਤੇ ਬਿਨਾਂ ਕਿਸੇ ਦੀ ਸਹਾਇਤਾ ਤੋਂ ਉਹਨਾਂ ਦਸਤਾਵੇਜ਼ਾਂ ਨੂੰ ਭਰ ਸਕਦੇ ਹਨ ਮੈਨੂੰ ਲਗਦਾ ਹੈ ਕਿ ਬੈਂਕਿੰਗ ਸੈਕਟਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਕੀਮ ਚੱਲ ਜਾਏਗੀ ਜਾਂ ਦਸਤਾਵੇਜ਼ਾਂ ਵਿੱਚ ਪੰਜਾਬੀ ਭਾਸ਼ਾ ਜਾਂ ਹਿੰਦੀ ਭਾਸ਼ਾ ਜਾਂ ਕੋਈ ਵੀ ਕਿਸੇ ਵੀ ਹ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਹੋਏਗਾ ਅਤੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਘੱਟ ਜਾਏਗਾ ਕਿਉਂਕਿ ਲੋਕ ਆਪਣੇ ਆਪ ਉਸ ਦਸਤਾਵੇਜ਼ਾਂ ਨੂੰ ਪੜ੍ਹ ਕੇ ਭਰ ਸਕਦੇ ਹਨ ਬਿਨਾਂ ਕਿਸੇ ਦੀ ਮੱਦਦ ਤੋਂ ਅਤੇ ਇਕ ਇਹ ਇੱਕ ਬਹੁਤ ਵੱਡਾ ਉਪਰਾਲਾ ਹੋਏਗਾ ਜੋ ਕਿਸੇ ਦੀ ਹੈਲਪ ਤੋਂ ਬਿਨਾਂ ਹਰ ਕੋਈ ਇਸ ਚੀਜ਼ ਦਾ ਜਾਗੂਰਿਕਤ ਹੋ ਜਾਗਰੂਕ ਹੋ ਜਾਏਗਾ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਦੀ ਮੱਦਦ ਦੀ ਲੋੜ ਨਹੀਂ ਪਵੇਗੀ ਇਸ ਦੇ ਕਾਰਨ ਇਸ ਦੇ ਫਾਇਦੇ ਹੋਰ ਵੀ ਹਨ ਕਿ ਕਈ ਘਰਾਂ ਦੇ ਵਿੱਚ ਵੱਡੇ ਪੜ੍ਹੇ ਲਿਖੇ ਨਹੀਂ ਹੁੰਦੇ ਪਰ ਬੱਚੇ ਪੜ੍ਹੇ ਲਿਖੇ ਹੁੰਦੇ ਹਨ ਉਹ ਵੀ ਉਨ੍ਹਾਂ ਦੀ ਇਸ ਚੀਜ਼ 'ਚ ਹੈਲਪ ਕਰ ਸਕਦੇ ਹਨ ਤਾਂ ਭਰਨ ਦੇ ਵਿੱਚ ਲਿਖਣ ਦੇ ਵਿੱਚ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਕ ਚੀਜ਼ਾਂ ਨੂੰ ਵਾਰ ਵਾਰ ਡਟੇਲ ਦੇ ਵਿੱਚ ਦੱਸਣ ਦੀ ਜ਼ਰੂਰਤ ਨਹੀਂ ਮੈਸਜ ਭੇਜਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਦਸਤਾਵੇਜ਼ਾਂ ਦੇ ਵਿਚ ਪੰਜਾਬੀ ਜਾਂ ਹਿੰਦੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਉਹ ਆਪਣੇ ਆਪ ਇਸ ਚੀਜ਼ ਦੇ ਨਾਲ ਜਾਗਰੂਕ ਹੋ ਜਾਣਗੇ ਅਤੇ ਇਹ ਬੈਂਕਿੰਗ ਸੈਕਟਰ ਦੇ ਲਈ ਬਹੁਤ ਵਧੀਆ ਉਪਰਾਲਾ ਹੋਏਗਾ